ਸਤਿ ਸ਼੍ਰੀ ਅਕਾਲ ਮੈਂ ਇੱਕ ਨਵਾਂ ਮੋਬਾਇਲ ਨੰਬਰ ਲਿਆ ਹੈ ਅਤੇ ਮੈਂ

ਨੂੰ ਪੈਨ ਕਾਰਡ ਰਿਕਾਰਡ ਅਪ ਡੇਟ ਕਰਵਾਉਣਾ ਚਾਹੁੰਦਾ ਹੈ ਕੀ ਤੁਸੀਂ ਮੈਨੂੰ ਆਪਣਾ ਸੰਪਰਕ ਨੰਬਰ ਅਪ ਡੇਟ ਕਰਨ ਲਈ ਨਿਰਦੇਸ਼ ਦੱਸ ਸਕਦੇ

ਮੇਰਾ ਪੈਨ ਕਾਰਡ ਨੰਬਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਜੀਰੋ ਹੈ ਅਤੇ ਮੋਬਾਇਲ ਨੰਬਰ ਅੱਠ ਨੌਂ ਸੱਤ ਛੇ ਪੰਜ ਚਾਰ ਦੋ ਤਿੰਨ ਇੱਕ ਜੀਰੋ ਹੈ